ਮੈਨੂੰ ਨਹੀਂ ਲੱਗਦਾ ਕਿ ਖਾਣਾ ਬਣਾਉਣਾ ਸਿਰਫ ਔਰਤਾਂ ਦਾ ਹੀ ਕੰਮ ਹੈ ਕਿਉਂਕਿ ਪਰਿਵਾਰ ਦੇ ਵਿੱਚ ਮਰਦਾਂ ਨੂੰ ਵੀ ਖਾਣਾ ਬਣਾਉਣਾ ਆਉਣਾ ਚਾਹੁੰਦਾ ਹੈ ਕਈ ਵਾਰ ਇੱਦਾਂ ਹੁੰਦਾ ਹੈ ਕਿ ਘਰ ਦੀਆਂ ਔਰਤਾਂ ਦੀ ਸਿਹਤ ਨਾ ਠੀਕ ਹੋਵੇ ਤਾਂ ਉਹ ਸਿਰਫ ਔਰਤਾਂ 'ਤੇ ਹੀ ਡਿਪੈਂਡ ਰਹਿ ਜਾਂਦੇ ਹਨ ਕੀ ਕਿਉਂਕਿ ਘਰ ਦੇ ਮਰਦਾਂ ਨੂੰ ਜੇ ਖਾਣਾ ਨਹੀਂ ਬਣਾਉਣਾ ਆਉਂਦਾ ਹੈ ਜਾਂ ਤਾਂ ਉਹ ਫਿਰ ਬਾਹਰ ਖਾਂਦੇ ਹਨ ਜਾਂ ਫਿਰ ਵਿਚਾਰੀਆਂ ਔਰਤਾਂ ਨੂੰ ਬਿਮਾਰੀ ਬਿਮਾਰੀ ਦੇ ਵਿੱਚ ਵੀ ਘਰਦਿਆਂ ਵਾਸਤੇ ਖਾਣਾ ਬਣਾਉਣਾ ਚਾਹੀਦਾ ਹੈ ਬਣਾਉਣਾ ਪੈਂਦਾ ਹੈ ਇਸ ਲਈ ਘਰਦੀਆਂ ਔਰਤਾਂ ਦੇ ਨਾਲ ਨਾਲ ਘਰਦੀਆਂ ਔਰਤਾਂ ਨੂੰ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਹੀ ਸ਼ੁਰੂ ਤੋਂ ਆਪਣੇ ਨਾਲ ਬੱਚਿਆਂ ਨੂੰ ਵੀ ਖਾਸ ਤੌਰ 'ਤੇ ਬੇਟਿਆਂ ਨੂੰ ਖਾਣਾ ਬਣਾਉਣਾ ਸਿਖਾਵੇ ਤਾਂ ਕਿ ਗਾਂਹ ਜਾ ਕੇ ਜੇਕਰ ਬੱਚਿਆਂ ਨੂੰ ਇਕੱਲੇ ਵੀ ਰਹਿਣਾ ਪਵੇ ਤਦ ਵੀ ਉਹ ਖਾਣਾ ਬਣਾਉਣ ਕ ਲਈ ਉਹਨਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ